ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਂ ਫੋਨ ਔਡਰ ਕੀਤਾ ਤਾ ਜੀ ਤੁਹਾਡਾ ਡ ਜੀ ਮੈਨੂੰ ਹਫਤੇ ਬਾਅਦ ਫੋਨ ਮਿਲਿਆ ਜੀ ਡਿਲੀਵਰੀ ਬੋਏ ਤੋਂ ਜੀ ਅ ਤੇ ਫੋਨ ਜਦੋਂ ਖੋਲ੍ਹਿਆ ਜੀ ਵਿੱਚੋਂ ਜਿਵੇਂ ਫੋਨ ਸੈਮਸੰਗ ਦਾ ਔਡਰ ਕੀਤਾ ਤਾ ਜੀ ਮੈਂ ਫੋਨ ਵੀ ਫੁੱਟਿਆ ਹੋਇਆ ਨਿਕਲਿਆ ਜੀ ਉਹਦਾ ਸਕਰੀਨ ਗਾਰਡ ਟੁੱਟਿਆ ਹੋਇਆ ਤਾ ਅਤੇ ਉਹਦੇ ਸਪੀਕਰ ਜਦ ਜਦੋਂ ਚਲਾਇਆ ਸਪੀਕਰ ਵੀ ਛਣਕੇ ਪਏ ਹੈ ਜੀ ਆਵਾਜ਼ ਹੀ ਨਹੀਂ ਆਉਂਦੀ ਹੈਗੀ ਵਿੱਚੋਂ ਫੋਨ ਦੇ ਹੋਰ ਜੀ ਉਹਦੇ ਵਿੱਚ ਕਈ ਖਰਾਬੀਆਂ ਜੀ ਹੈਂਗ ਹੁੰਦਾ ਹੈ ਜੀ ਅਤੇ ਹੈੱਡਫੋਨ ਨਾਲ਼ ਔਡਰ ਕਰੇ ਤੇ ਜੀ ਹੈੱਡਫੋਨ ਵੀ ਨਹੀਂ ਮਿਲੇ ਹੈਗੇ ਤੁਸੀਂ ਤਾਂ ਕਿਹਾ ਤਾ ਜੀ ਵੀ ਹੈੱਡਫੋਨ ਨਾਲ਼ ਮਿਲਣਗੇ ਮੋਬਾਇਲ ਦੇ ਹੋਰ ਜੀ ਹਾਂਜੀ ਭਾਅ ਜੀ ਜਮੀ ਮਤਲਬ ਫੋਨ ਤਾਂ ਤੁਹਾਡਾ ਡਿਲੀਵਰੀ ਹੀ ਬਹੁਤ ਲੇਟ ਆ ਰਹੀ ਹੈ ਜੀ ਇਸ ਕਰਕੇ ਤੁਹਾਨੂੰ ਫੋਨ ਕਰਿਆ ਤਾ ਜੀ ਚਲੋ ਭਾਅ ਜੀ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ